ਤੀਹ ਮਈ ਉੱਨੀ ਸੌ ਅੱਸੀ ਸਤਾਈ ਸਤੰਬਰ ਉੱਨੀ ਸੌ ਇਕਿਆਸੀ ਬਾਰ੍ਹਾਂ ਮਾਰਚ ਉੱਨੀ ਸੌ ਚੁਰਾਸੀ ਪੰਦਰ੍ਹਾਂ ਮਈ ਉੱਨੀ ਸੌ ਅੱਸੀ ਛੱਬੀ ਜਨਵਰੀ ਉੱਨੀ ਸੌ ਬਹੱਤਰ